ਕਵਿਤਾ ਅਤੇ ਪ੍ਰਗਟਾਵੇ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਕਦੇ ਕਿਸੇ ਵਿਚਾਰ ਭਾਵਨ ਜਾਂ ਕਿਸੇ ਗੱਲ ਨੂੰ ਸ਼ਬਦਾਂ ਦੀ ਸ਼ੈਲੀ ਵਿੱਚ ਵਿਆਖਿਆ ਕਰਨੀ ਹੈ ਪੰਜਾਬੀ ਭਾਸ਼ਾ ਦੀ ਵਰਤੋਂ ਕਰਨਾ ਵਿੱਚ ਉਹਨਾਂ ਦੀ ਆਤਮਾ ਨੂੰ ਸਮਝਣਾ ਅਤੇ ਓ ਉਸ ਨੂੰ ਸ਼ਬਦਾਂ ਵਿੱਚ ਵਿਆਖਿਆ ਕਰਨਾ ਅਹਿਮ ਹੈ ਜਿਵੇਂ ਕਿ ਪੰਜਾਬੀ ਭਾਸ਼ਾ ਵਿੱਚ ਕਵਿਤਾ ਗੀਤ ਜਾਂ ਕਹਾਣੀ ਵਿੱਚ ਭਾਸ਼ਾ ਦੀ ਕਵਿਤਾ ਵਿੱਚ ਉਹ ਆਪਣੇ ਜੀਵਨ ਦੀ ਅਨੁਭਵਾ ਸਮਾਜਿਕ ਸੋਚ ਅਤੇ ਦੁਨੀਆਵੀ ਮਹਿ ਮਹਿਮ ਨੂੰ ਵਿਆਖਿਆ ਕਰਦਾ ਸੀ ਇਸ ਨੂੰ ਵਿਚਾਰ ਕਰਨਾ ਅਤੇ ਸ਼ਬਦਾਂ ਵਿੱਚ ਵਿਆਖਿਆ ਕਰਨਾ ਪੰਜਾਬੀ ਕਵਿਤਾ ਦੀ ਇੱਕ ਵਿਸ਼ੇਸ਼ਤਾ ਹੈ ਪੰਜਾਬੀ ਭਾਸ਼ਾ ਦੀ ਕਵਿਤਾ ਨੂੰ ਪੜ੍ਹਨ ਜਾਂ ਸੁਣਨ ਵਾਲੇ ਨੂੰ ਉਹਨਾਂ ਦਾ ਇੱਕ ਸਿਰਫ਼ ਸਥਾਨ ਤੱਕ ਲੈ ਜਾਂਦੀ ਹੈ ਬਲਕਿ ਉਸ ਦੇ ਮਾਧਿਅਮ ਉਹਨਾਂ ਦੇ ਦਿਲ ਵਿੱਚੋਂ ਇੱਕ ਸੰਦੇਸ਼ ਵੀ ਲਈ ਵੀ ਰੋਸ਼ਨੀ ਪੈਂਦੀ ਹੈ ਇਸ ਵਿੱਚ ਉਹਨਾਂ ਦੀ ਸੋਚ ਦੀ ਪ੍ਰਕਾਸ਼ ਹੁੰਦੀ ਹੈ ਅਤੇ ਉਹ ਇ ਉਹ ਵਿਚਾਰ ਨੂੰ ਸ਼ਬਦਾਂ ਵਿੱਚ ਪੀਰੋ ਦੇਣ ਵਾਲੀ ਸ਼ੈਲੀ ਵਿੱਚ ਪ੍ਰਗਟ ਹੁੰਦੀ ਹੈ ਇਸ ਤਰ੍ਹਾਂ ਪੰਜਾਬੀ ਭਾਸ਼ਾ ਦੀ ਕਵਿਤਾ ਪਾਠਕਾਂ ਦੇ ਸੰਬੰਧ ਵਿੱਚ ਉਹਨਾਂ ਨੂੰ ਵਿਚਾਰਾਤਮਕ ਅਤੇ ਸਾਹਿਤਕ ਅਨੁਭਵ ਨੂੰ ਸਾਂਝਾ ਕਰਨ ਦਾ ਸੁਨਹਿਰਾ ਮੌਕਾ ਵੀ ਦਿੰਦੀ ਹੈ ਪੰਜਾਬੀ ਭਾਸ਼ਾ ਦੀ ਕਵਿਤਾ ਸਾਹਿਤਕ ਸੰਦੇਵਾ ਨੂੰ ਵਿਸ਼ੇਸ਼ ਅਤੇ ਸ਼ਾਨਦਾਰ ਤਰੀਕੇ ਨਾਲ ਵਿਆਖਿਆ ਕੀਤਾ ਜਾਂਦਾ ਹੈ ਇਸ ਜਰੀਏ ਕਵੀ ਆਪਣੇ ਆਤਮਿਕ ਅਤੇ ਸਮਾਜਿਕ ਵਿਚਾਰਾਂ ਨੂੰ ਸ਼ਬਦਾਂ ਵਿੱਚ ਪ੍ਰਗਟ ਕਰਦਾ ਹੈ ਅਤੇ ਪ੍ਰਕਾਸ਼ ਹੁੰਦੇ ਹਨ ਇਸ ਤਰਾਕਲੀ ਤਰੀਕੇ ਨਾਲ ਉਹ ਸਮਾਜ ਵਿੱਚ ਇਕੱਠੇ ਰਹਿਣ ਦੇ ਮੇਲ ਹੁੰਦੇ ਹਨ ਉਚਿੱਤ ਰੂਪ ਵਿੱਚ ਕੁਝ ਨਾਗਰ ਕਾਰਨ ਦਾ ਪ੍ਰਰਿਣਾਮ ਕਰਦੇ ਹਨ ਪੰਜਾਬੀ ਭਾਸ਼ਾ ਦੀ ਕਵਿਤਾ ਪੰਜਾਬ ਭਾਸ਼ਾ ਅਤੇ ਸਮਾਜ ਦੀ ਸ਼ਾਨਦਾਰ ਵਿਰਾਸਤ ਨੂੰ ਹਿੱਸਾ ਹੈ ਅਤੇ ਇਸ ਨੂੰ ਸਾਂਝਾ ਕਰਨਾ ਪ੍ਰਸ਼ੰਸ਼ਨੀਏ ਹੈ